ਹੈਲੋ ਹਾਂਜੀ ਗੁਡ ਮੋਰਨਿੰਗ ਹਾਂਜੀ ਮੈਮ

ਹਾਂਜੀ ਮੈਮ ਓਕੇ ਹਾਂਜੀ ਹੈਲੋ ਹਾਂਜੀ ਹਾਂਜੀ ਕਿਸ ਚੀਜ਼ ਦੀ ਐਫ ਡੀ ਮੈਮ ਹਾਂਜੀ ਹਾਂਜੀ ਕਿੰਨ ਕਿੰਨਾ ਕੈਸ਼ ਲੱਗੇਗਾ ਓਕੇ ਪਰਸਨਲ ਇਨਫੋਰਮੇਸ਼ਨ ਹੈ ਕੋਈ ਹਾਂਜੀ ਕਿੰਨਾ ਪਰਸੈਂਟ ਰਿਟਰਨ ਹੋਵੇਗਾ ਮੈਮ ਓਕੇ ਕਿਸੇ ਕੋਲ ਸ਼ੇਅਰ ਤਾਂ ਨਹੀਂ ਹੋ ਰਹੀ ਮੈਮ ਪਰਸਨਲ ਇਨਫੋਰਮੇਸ਼ਨ ਬੈਨੀਫਿਟ ਹੈ ਕੋਈ ਮੈਮ ਇਸ 'ਚ ਹੋਰ ਕੋਈ ਡਿਟੇਲਸ ਮੈਮ ਹਾਂਜੀ ਓਕੇ ਕੀ ਕੀ ਡਾਕੂਮੈਂਟਸ ਚਾਹੀਦੇ ਨੇ ਮੈਮ ਇਸ 'ਚ ਹਾਂਜੀ ਹਾਂਜੀ ਓਕੇ ਹਾਂਜੀ ਹਾਂਜੀ ਓਕੇ ਹੋਰ ਕੋਈ ਡਿਟੇਲਸ ਮੈਮ ਹਾਂਜੀ ਹਾਂਜੀ ਓਕੇ ਮੈਮ ਬੈਨੀਫਿਟ ਕੀ ਹੈ ਮੈਮ ਇਸ ਦਾ ਮੈਨੂੰ ਡਬਲ ਹੋ ਕੇ ਆਉਣਗੇ ਮੈਮ ਪੈਸੇ ਕਿੰਨਾ ਮੈਮ ਓਕੇ ਓਕੇ ਮੈਮ ਮੈਮ ਪਰਸਨਲ ਇਨਫੋਰਮੇਸ਼ਨ ਕਿਸੇ ਕੋਲ ਸ਼ੇਅਰ ਤਾਂ ਨਹੀਂ ਹੋਊਗੀ ਓਕੇ ਥੈਂਕ ਯੂ ਮੈਮ